ਹੈਲੋ ਹਾਂਜੀ ਮੈਂ ਅੰਮ੍ਰਿਤਸਰ ਤੋਂ ਬੋਲ ਰਿਹਾ ਜੀ ਤੁਸੀਂ ਮੋਹਾਲੀ ਤੋਂ ਬੋਲ ਰਹੇ ਹੋ ਭਾਅ ਜੀ ਐਕਚੁਅਲ 'ਚ ਨਾ ਮੈਂ ਇੱਥੇ ਟੂਰ ਲਈ ਆ ਰਿਹਾ ਘੁੰਮਣ ਫਿਰਨ ਲਈ ਮੋਹਾਲੀ ਅਤੇ ਮੈਂ ਸਰਚ ਕਰਕੇ ਦੇਖਿਆ ਸੀ ਤੁਹਾਡੇ ਪਾਲ ਢਾਬਾ ਹੈ ਇੱਥੇ ਕੋਈ ਤੁਹਾਡਾ ਹੀ ਹੈ ਜੀ ਹਾਂਜੀ ਮੈਂ ਉਹਦੇ ਬਾਰੇ ਪੁੱਛਣਾ ਸੀ ਕਿ ਉੱਥੇ ਫੂਡ ਹੈ ਜੋ ਕਿਵੇਂ ਹੈ ਜੀ ਹੋਰਾਂ ਨਾਲੋਂ ਬੈਟਰ ਹੈ ਠੀਕ ਹੈ ਜੀ ਠੀਕ ਹੈ ਮਤਲਬ ਪੰਜ ਫ਼ੇਸ 'ਚ ਹੈ ਜੀ ਅਤੇ ਮਤਲਬ ਪੰਜ ਫ਼ੇਸ 'ਚੋਂ ਜਿਵੇਂ ਟੂਰੈਸਟ ਪਲੇਸਿਸ ਹੈ ਚੰਡੀਗੜ੍ਹ 'ਚ ਮੈਂ ਸਰਚ ਕੀਤੀ ਸੁਖਨਾ ਲੇਕ ਰੋਜ਼ ਗਾਰਡਨ ਹੋਰ ਵੀ ਜਿੰਨਾ ਕੁਛ ਉਹ ਨਜ਼ਦੀਕ ਹੀ ਹੈ ਜੀ ਮਤਲਬ ਇੱਥੇ ਫੂਡ ਹੈ ਜਿਹੜਾ ਪਾਲ ਢਾਬੇ ਦਾ ਇਹ ਇਹ ਬੈਟਰ ਹੈ ਜੀ ਵਧੀਆ ਹੈ ਫਰੈਸ਼ ਮਿਲਦਾ ਅਤੇ ਭਾਅ ਜੀ ਵੈੱਜ ਨੌਨ ਵੈੱਜ ਦੋਨੇਂ ਮਿਲ ਜਾਂਦੇ ਜੀ ਇੱਥੇ ਠੀਕ ਹੈ ਜੀ ਠੀਕ ਹੈ ਬਹੁਤਾ ਐਕਸਪੈਂਸਿਵ ਤਾਂ ਨਹੀਂ ਹੈ ਜੀ ਇਹ ਠੀਕ ਹੈ ਜੀ ਜਾਣਕਾਰੀ ਦੇਣ ਲਈ ਧੰਨਵਾਦ ਜੀ